ਚਿੱਤਰਕਾਰੀ ਬਣਾਉਣ ਸਮੇਂ ਬਹੁਤ ਸਾਰੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਸਭ ਤੋਂ ਪਹਿਲਾਂ ਤਾਂ ਇਸ ਲਈ ਇਕਾਗਰਤਾ ਹੋਣੀ ਬਹੁਤ ਜ਼ਰੂਰੀ ਹੈ ਅਤੇ ਆਸੇ ਪਾਸੇ ਸ਼ੋਰ ਸ਼ਰਾਬਾਂ ਨਹੀਂ ਹੋਣਾ ਚਾਹੀਦਾ ਸਾਨੂੰ ਚਿੱਤਰਕਾਰੀ ਬਣਾਉਣ ਲਈ ਬਹੁਤ ਸਾਰੇ ਸਮਾਨ ਦੀ ਜ਼ਰੂਰਤ ਪੈਂਦੀ ਹੈ ਜਿਵੇਂ ਕਿ ਪੈਨਸਲ ਇਹਨਾਂ ਵਿੱਚ ਐੱਚ ਵਨ ਐੱਚ ਟੂ ਐੱਚ ਥ੍ਰੀ ਐੱਚ ਫੋਰ ਐੱਚ ਫਾਇਵ ਅਤੇ ਐੱਚ ਸਿਕਸ ਤਰ੍ਹਾਂ ਦੀਆਂ ਪੈਨਸਲਾਂ ਮਿਲ ਜਾਂਦੀਆਂ ਹਨ ਅਤੇ ਇਸ ਤੋਂ ਇਲਾਵਾ ਵਾਟਰ ਕਲਰ ਪੇਪਰ ਸਕੈੱਚ ਕਲਰ ਪੈਨਸਲ ਕਲਰ ਮੋਮੀ ਕਲਰ ਰੇਜਰ ਅਤੇ ਕੈਨਵਸ ਦੀ ਜ਼ਰੂਰਤ ਪੈਂਦੀ ਹੈ ਅਤੇ ਅਤੇ ਅਸੀਂ ਚਿੱਤਰਕਾਰੀ ਕਰਨ ਲਈ ਬਰੱਸ਼ ਦੀ ਜ ਵਰਤੋਂ ਵੀ ਕਰ ਸਕਦੇ ਹਾਂ ਮੈਂ ਪਿੱਛੇ ਜਿਹੇ ਦੋ ਚਿੱਤਰ ਬਣਾਏ ਸਨ ਜਿਸ ਵਿੱਚ ਇੱਕ ਛੋਟੇ ਬੱਚੇ ਦਾ ਚਿੱਤਰ ਬਣਾਇਆ ਸੀ ਜੋ ਬਹੁਤ ਹੀ ਵਧੀਆ ਬਣਿਆ ਅਤੇ ਉਸ ਤੋਂ ਬਾਅਦ ਮੈਂ ਆਪਣਾ ਚਿੱਤਰ ਬਣਾਇਆ ਜਿਸ ਵਿੱਚ ਮੈਨੂੰ ਕੁਛ ਕਮੀਆਂ ਨਜ਼ਰ ਆਈਆਂ ਇਸ ਤੋਂ ਅੱਗੇ ਮੈਂ ਇਹ ਕਮੀਆਂ ਦੂਰ ਕਰਾਂਗੀ